ਸਕੂਲ ਵਿੱਚ ਅਧਿਆਪਕਾਂ ਨੂੰ ਪੜ੍ਹਾਉਣ ਲਈ ਸਭ ਤੋਂ ਪਹਿਲਾਂ ਤਾਂ ਸਕੂਲ ਦੇ ਵਿੱਚ ਬਲੈਕਬੋਰਡ ਚਾਕ ਡਸਟਰ ਜਿਹਦੇ ਨਾਲ਼ ਅਧਿਆਪਕ ਬੱਚਿਆਂ ਨੂੰ ਬਲੈਕਬੋਰਡ 'ਤੇ ਸਾਫ਼ ਸੁਥਰਾ ਲਿਖ ਸਕੇ ਕਈ ਵਾਰੀ ਬਲੈਕਬੋਰਡ ਦੇ ਉੱਤੇ ਚਾਕ ਨਾਲ਼ ਲਿਖਦੇ ਹਾਂ ਤਾਂ ਉਹ ਸਾਫ਼ ਹੀ ਨਹੀਂ ਬੱਚਿਆਂ ਨੂੰ ਦਿਖਦਾ ਹੈਗਾ ਇਸ ਕਰਕੇ ਖ਼ਾਸ ਕਰਕੇ ਜਿਹੜੀ ਮੇਨ ਚੀਜ਼ ਹੈਗੀ ਆ ਬਲੈਕਬੋਰਡ ਚੌਕ ਅਤੇ ਡਸਟਰ ਪਰ ਅੱਜ ਕੱਲ੍ਹ ਤਾਂ ਇਹ ਖਤਮ ਹੀ ਹੋ ਗਿਆ ਬਲੈਕਬੋਰਡ ਵੀ ਖ਼ਤਮ ਹੋ ਗਿਆ ਚਾਕ ਅਤੇ ਡਸਟਰ ਬਿਲਕੁਲ ਹੀ ਖ਼ਤਮ ਹੋ ਗਿਆ ਪਰ ਇਹ ਕਾਫ਼ੀ ਦੁਬਾਰਾ ਕੀਤੀ ਜਾਵੇ ਤਾਂ ਬੱਚਿਆਂ ਨੂੰ ਜ਼ਿਆਦਾ ਹੀ ਵਧੀਆ ਪੜ੍ਹਿਆ ਜਾ ਸਕਦਾ ਕਿਉਂ ਜਦੋਂ ਬੱਚਾ ਲਿਖਦਾ ਬਲੈਕਬੋਰਡ ਤੋਂ ਲਿਖਦਾ ਹੈਗਾ ਇੱਕ ਤਾਂ ਉਹ ਸ਼ਬਦ ਦੀ ਬਣਤਰ ਦੇਖਦਾ ਹੈਗਾ ਇੱਕ ਉਹਨੂੰ ਲਿਖਣ ਦੇ ਵਿੱਚ ਲਗਾਂ ਮਾਤਰਾ ਦਾ ਧਿਆਨ ਰੱਖਦਾ ਹੈਗਾ ਜਿਵੇਂ ਕਿ ਪੰਜਾਬੀ ਓ ਲੈ ਲਓ ਪੰਜਾਬੀ ਦੇ ਵਿੱਚ ਔਂਕੜ ਦੁਲੈਂਕੜ ਲਾਵਾਂ ਦੁਲਾਵਾਂ ਕੰਨਾ ਬਿੰਦੀ ਹੋੜਾ ਇਹ ਜਿਹੜੇ ਸਾਡੀਆਂ ਲਗਾਂ ਮਾਤਰਾ ਨੇ ਇਹ ਬਹੁਤ ਹੀ ਲਾਭਦਾਇਕ ਨੇ ਪਰ ਬੱਚਿਆਂ ਨੂੰ ਇਹ ਗੱਲ ਸਮਝ ਨਹੀਂ ਆਉਂਦੀ ਹੈਗੀ ਵੀ ਕਿੱਥੇ ਲਾਵਾਂ ਲਾਉਣੀ ਹੈ ਕਿੱਥੇ ਦੁਲਾਵਾਂ ਲਾਉਣੀ ਹੈ ਕਿੱਥੇ ਔਂਕੜ ਲਾਉਣਾ ਹੈਗਾ ਕਿੱਥੇ ਦੁਲੈਂਕੜ ਲਾਉਣਾ ਹੈਗਾ ਪਰ ਅਧਿਆਪਕ ਨੂੰ ਇਹ ਪੜ੍ਹਾਉਣ ਲਈ ਬਹੁਤ ਚੀਜ਼ਾਂ ਦਾ ਖਿਆਲ ਰੱਖਣਾ ਪੈਂਦਾ ਹੈਗਾ ਕਿ ਬੱਚੇ ਉਹਨਾਂ ਚੀਜ਼ਾਂ ਵੱਲ ਧਿਆਨ ਦੇਣ ਅਤੇ ਇਹਨਾਂ ਸਕੂਲਾਂ ਦੇ ਸਕੂਲਾਂ ਦੇ ਵਿੱਚ ਜ਼ਿਆਦਾ ਕਰਕੇ ਬੱਚਿਆਂ ਦੀ ਕਮੀ ਬੱਚਿਆਂ ਦੀ ਕਮੀ ਜ਼ਿਆਦਾ ਹੈਗੀ ਆ ਪਰ ਕੋਈ ਟੀਚਰਾਂ ਦੀ ਵੀ ਕਮੀ ਹੁੰਦੀ ਆ ਪੜ੍ਹਾਉਣ ਦੇ ਵਿੱਚ ਥੋੜ੍ਹੇ ਜਿਹੇ ਉਹ ਦਿਲਚਸਪੀ ਨਾਲ ਪੜ੍ਹਾਇਆ ਜਾਵੇ ਤਾਂ ਬੱਚਾ ਵੀ ਸ ਪੜ੍ਹ ਜਾਂਦਾ ਹੈਗਾ ਸਮਝਦਾ ਹੈਗਾ ਹਰ ਗੱਲ ਨੂੰ